ਪੰਜਾਬੀ ਭੰਗੜੇ ਲਈ ਬਹੁਤ ਸਾਰੇ ਸਕੂਲਾਂ ਕਾਲਜਾਂ ਵਿੱਚ ਕੌਪੀਟੀਸ਼ਨ ਕਰਵਾਏ ਜਾਂਦੇ ਹਨ ਇਸ ਤੋਂ ਇਲਾਵਾ ਪੰਜਾਬੀ ਭੰਗੜੇ ਲਈ ਹਰ ਤਰ੍ਹਾਂ ਦੇ ਤਿਆਰੀ ਲਈ ਕੋਚਿੰਗ ਸੈਂਟਰ ਵੱਖ ਵੱਖ ਤਰ੍ਹਾਂ ਦੇ ਖੋਲ੍ਹੇ ਗਏ ਨੇ ਸੱਭਿਆਚਾਰਕ ਪ੍ਰੋਗਰਾਮ ਜਦੋਂ ਹੁੰਦੇ ਨੇ ਪੰਜਾਬੀ ਭੰਗੜਾ ਦੇ ਖ਼ਾਸ ਪ੍ਰੋਗਰਾਮ ਕੀਤਾ ਜਾਂਦਾ ਹੈ ਭੰਗੜਾ ਪੰਜਾਬ ਦਾ ਇਹ ਕਲਚਰ ਹੈ ਪੰਜਾਬੀ ਭੰਗੜਾ ਪੰਜਾਬ ਦੀ ਸ਼ਾਨ ਹੁੰਦੀ ਹੈ ਪੰਜਾਬੀ ਭੰਗੜੇ ਦੇ ਕਈ ਇੰਸਟੀਚਿਊਟ ਸਾਡੇ ਸ਼ਹਿਰ ਵਿੱਚ ਵੀ ਨੇ ਕਈ ਤਰ੍ਹਾਂ ਦੇ ਪ੍ਰਾਈਵੇਟ ਪੀ ਟੀ ਸੀ ਨਿਊਜ਼ ਵਿੱਚ ਵੀ ਕਈ ਤਰ੍ਹਾਂ ਦੇ ਪ੍ਰੋਗਰਾਮ ਵੀ ਭੰਗੜੇ ਦੇ ਰਿਲੇਟਡ ਕਰਾਏ ਜਾਂਦੇ ਨੇ ਪੰਜਾਬੀ ਭੰਗੜਾ ਇੱਕ ਇਸ ਤਰ੍ਹਾਂ ਦਾ ਹੈ ਕਿ ਇਸ ਨਾਲ ਸਰੀਰ ਦੀ ਕਸਰਤ ਵੀ ਹੋ ਜਾਂਦੀ ਹੈ ਸਰੀਰ ਵੀ ਸਾਡਾ ਤੰਦਰੁਸਤ ਹੋ ਜਾਂਦਾ ਹੈ ਪੰਜਾਬੀ ਭੰਗੜਾ ਪੰਜਾਬੀਅਤ ਦਾ ਪੰਜਾਬੀਅਤ ਦੀ ਨਿਸ਼ਾਨੀ ਹੈ ਪੰਜਾਬੀ ਭੰਗੜਾ ਇਸ ਤਰ੍ਹਾਂ ਦਾ ਹੁੰਦਾ ਹੈ ਕਿ ਸਾਰੇ ਲੋਕ ਇਸ ਨੂੰ ਦੇਖ ਕੇ ਢੋਲ 'ਤੇ ਨੱਚਣ ਲੱਗ ਪੈਂਦੇ ਨੇ ਪੰਜਾਬੀ ਭੰਗੜੇ ਵਿੱਚ ਸਾਡੇ ਸ਼ਹਿਰ ਵਿੱਚ ਕਈ ਤਰ੍ਹਾਂ ਦੇ ਮੁਕਾਬਲੇ ਸਕੂਲਾਂ ਕਾਲਜਾਂ ਵਿੱਚ ਕਰਵਾਏ ਜਾਂਦੇ ਨੇ ਪੰਜਾਬੀ ਭੰਗੜਾ ਕਿਸੇ ਵਿਆਹ ਸਮਾਰੋਹ ਵਿੱਚ ਵੀ ਆਮ ਤੌਰ 'ਤੇ ਕਰਵਾਇਆ ਜਾਂਦਾ ਹੈ ਲੋਕਾਂ ਦੇ ਮਨੋਰੰਜਨ ਕਰਵਾਉਣ ਲਈ ਪੰਜਾਬੀ ਭੰਗੜੇ ਦਾ ਖ਼ਾਸ ਪ੍ਰਬੰਧ ਕੀਤਾ ਜਾਂਦਾ ਹੈ ਕਈ ਤਰ੍ਹਾਂ ਦੇ ਪੰਜਾਬੀ ਸਿੰਗਰ ਬਹੁਤ ਵਧੀਆ ਤਰੀਕੇ ਨਾਲ ਪੰਜਾਬੀ ਭੰਗੜੇ ਵਿੱਚ ਬਹੁਤ ਦਾ ਨਾਮ ਬਣਾ ਚੁੱਕੇ ਨੇ ਅੱਜ ਕੱਲ੍ਹ ਪੰਜਾਬ ਨੂੰ ਪੰਜਾਬ ਤੋਂ ਬਾਹਰ ਵੀ ਪੰਜਾਬੀ ਭੰਗੜੇ ਦੀ ਵੱਖਰੀ ਸ਼ਾਨ ਹੈ ਪੰਜਾਬੀ ਭੰਗੜਾ ਪੰਜਾਬ ਤੋਂ ਬਾਹਰ ਪੂਰੇ ਵਰਲਡ ਵਿੱਚ ਵੀ ਫੇਮਸ ਹੈ